ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਮਾਰਕੀਟ ਵਧੀਆ ਨੇ ਜਿਵੇਂ ਦੇਖੋ ਜੀ ਕਿਲਾ ਚੌਂਕ ਹੋ ਗਿਆ ਅਨਾਰ ਦਾਨਾ ਚੌਂਕ ਹੋ ਗਿਆ ਭਾਂਡਿਆਂ ਵਾਲਾ ਬਜ਼ਾਰ ਹੋ ਗਿਆ ਇਹ ਸਾਰੇ ਮਾਰਕੀਟ ਬਹੁਤ ਵਧੀਆ ਨੇ ਇਹ ਚੀਜ਼ਾਂ ਲਈ ਹਾਂਜੀ ਦੇਖੋ ਜਿਵੇਂ ਕਿਲਾ ਚੌਂਕ ਆ ਉਹ 'ਚ ਤੁਹਾਨੂੰ ਜਿਵੇਂ ਕੱਪੜੇ ਹੋ ਗਏ ਹੋਰ ਸਮਾਨ ਹੋ ਗਿਆ ਜਿਵੇਂ ਭਾਂਡੇ ਵਗੈਰਾ ਹੋ ਗਏ ਜਾਂ ਹੋਰ ਕੋਈ ਵੀ ਵਰਤੋਂ ਦਾ ਤੁਹਾਨੂੰ ਰੋਜ਼ ਦੀ ਵਰਤੋਂ ਦਾ ਕੋਈ ਵੀ ਸਮਾਨ ਹੈ ਉਹ ਉੱਥੋਂ ਦੀ ਮਿਲ ਸਕਦਾ ਮਤਲਬ ਉੱਥੇ ਘੱਟ ਰੇਟ ਵੀ ਹੁੰਦੇ ਆ ਹਾਂਜੀ ਵੀ ਦੇਖੋ ਜਿਹੜਾ ਭਾਂਡੇ ਵਾਲਾ ਬਜ਼ਾਰ ਆ ਉੱਥੇ ਤੁਹਾਨੂੰ ਘੱਟ ਰੇਟਾਂ 'ਤੇ ਭਾਂਡੇ ਮਿਲ ਸਕਦੇ ਨੇ ਹੈ ਨਾ ਜੀ ਅਤੇ ਵਧੀਆ ਵੀ ਮਿਲ ਜਾਂਦੇ ਆ ਅਨਾਰ ਦਾਨਾ ਚੌਂਕ ਤਾਂ ਆਪਾਂ ਜਿਵੇਂ ਵਿਆਹ ਵਗੈਰਾ ਲਈ ਕੱਪੜੇ ਲੀੜੇ ਖਰੀਦ ਸਕਦੇ ਹਾਂ ਹਾਂਜੀ ਅਤੇ ਉੱਥੇ ਰੇਟ ਵੀ ਠੀਕ ਹੁੰਦੇ ਹੈ ਹਾਂਜੀ ਦੇਖੋ ਜਿਹੜੇ ਕਿਲਾ ਚੌਂਕ ਆ ਉਹ ਤੁਹਾਨੂੰ ਘਰ ਤੋਂ ਵੀ ਜ਼ਿਆਦਾ ਨੇੜੇ ਪਏਗਾ ਹਾਂਜੀ ਦੇਖੋ ਇੱਕ ਪਟਿਆਲੇ ਵਿੱਚ ਇੱਕ ਸੰਡੇ ਮਾਰਕੀਟ ਲੱਗਦੀ ਆ ਉੱਥੇ ਆਪਾਂ ਜਾ ਸਕਦੇ ਹਾਂ ਉੱਥੇ ਵੀ ਸਮਾਨ ਬਹੁਤ ਸਸਤਾ ਹੁੰਦਾ ਅਤੇ ਵਧੀਆ ਹੁੰਦਾ ਹਾਂਜੀ ਵੈਸੇ ਮੈਨੂੰ ਵੈਸੇ ਮੈਨੇ ਸੰਡੇ ਨੂੰ ਜਾਣਾ ਹੀ ਸੀ ਮੈਨੂੰ ਕੰਮ ਹੀ ਸੀ ਜੇ ਤੁਸੀਂ ਚਾਹੋਗੇ ਤਾਂ ਮੇਰੇ ਨਾਲ ਸੰਡੇ ਨੂੰ ਜਾ ਸਕਦੇ ਹੋ ਬਜ਼ਾਰ ਜੇ ਕੁਛ ਸਮਾਨ ਲੈਣਾ ਘਰ ਦੇ ਲਈ ਹਾਂਜੀ ਹਾਂਜੀ ਮੈਂ ਨਾ ਇੱਕ ਵਾਰੀ ਪਹਿਲਾਂ ਸ਼ੁੱਕਰਵਾਰ ਨੂੰ ਫੋਨ ਕਰ ਦਾਂਗੀ ਜਾਂ ਸ਼ਨੀਵਾਰ ਫੋਨ ਕਰ ਦਾਂਗੀ ਤੁਹਾਨੂੰ ਇੱਕ ਵਾਰੀ ਹੈ ਨਾ ਜੀ ਤਾਂ ਫਿਰ ਜੋ ਤੁਹਾਡਾ ਪਲੈਨ ਹੋਏਗਾ ਤੁਸੀਂ ਮੈੈਨੂੰ ਦੱਸ ਦਿਓ ਫਿਰ ਆਪਾਂ ਇਕੱਠੇ ਜਾ ਆਵਾਂਗੇ ਬਜ਼ਾਰ ਹਾਂਜੀ ਹਾਂਜੀ ਤੁਹਾਨੂੰ ਸਭ ਕੁਛ ਵਧੀਆ ਮਿਲ ਜਾਏਗਾ ਅਤੇ ਘੱਟ ਰੇਟਾਂ 'ਤੇ ਮਿਲ ਜਾਏਗਾ ਜੀ ਸੰਡੇ ਮਾਰਕਿਟ 'ਚੋਂ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਵਾਰੀ ਸ਼ਨੀਵਾਰ ਨੂੰ ਰਾਤ ਰਾਤ ਨੂੰ ਫੋਨ ਕਰ ਦਾਂਗੀ ਫਿਰ ਜੋ ਤੁਹਾਡਾ ਹੋਏਗਾ ਤੁਸੀਂ ਮੈਨੂੰ ਦੱਸ ਦੇਣਾ ਕੋਈ ਗੱਲ ਨਹੀਂ ਜੀ